ਹੈਲੋ ਠੀਕ ਹੈ ਵਧੀਆ ਤੁਸੀਂ ਸੁਣਾਓ ਹੋਰ ਪਹਿਛਾਣ ਲਿਆ ਪਛਾਣ ਲਿਆ ਹੋਰ ਠੀਕ ਠਾਕ ਨਹੀਂ ਨਹੀਂ ਨੰਬਰ ਫੀਡ ਆ ਨੰਬਰ ਕਿਉਂ ਨੀ ਫੀਡ ਮਿਲਣ ਗਿਲਣ ਵਾਲੇ ਬੰਦੇ ਦਾ ਨੰਬਰ ਥੋੜ੍ਹੀ ਆ ਸੇਵ ਨਾ ਕਰਾਂਗੇ ਠੀਕ ਵਧੀਆ ਤੁਸੀਂ ਸੁਣਾਓ ਕਿਵੇਂ ਚੱਕਰ ਚੁੱਕਰ ਹੀ ਨਹੀਂ ਮਾਰਿਆ ਤੁਸੀਂ ਅੱਛਾ ਕੱਲ੍ਹ ਆਉਣਾ ਸੀ ਕਿ ਕੱਲ੍ਹ ਆਉਗੇ ਟ੍ਰੈਫਿਕ ਤਾਂ ਪੁੱਛੋ ਨਾ ਟਰੈਫਿਕ ਤਾਂ ਬੜਾ ਬੁਰਾ ਹਾਲ ਕਰਿਆ ਪਿਆ ਅੱਛਾ ਨਹੀਂ ਨਹੀਂ ਪੁਲ ਉੱਪਰ ਦੀ ਹੁਣ ਵਧੀਆ ਪੁਲ ਉੱਪਰ ਦੀ ਜਲਦੀ ਚਲਿਆ ਜਾਂਦਾ

ਇਹ ਤਾਂ ਹੈ ਇਕ ਆਹ ਭੁੰਡੀਆਂ ਜਿਹੀਆਂ ਬੜੀਆਂ ਵਧੀਆਂ ਪਈਆਂ ਇਹਾਨਾਂ ਨੂੰ ਚਲਾਉਣੀਆਂ ਨਹੀਂ ਆਉਂਦੀਆਂ ਲੈ ਕੇ ਤੁਰੇ ਫਿਰਦੇ ਐਵੇਂ ਹੀ ਪਤਾ ਨੀ ਲੱਗਦਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਜਿੱਦਾਂ ਜੀ ਆਉਂਦਾ ਉਧਰ ਮੋੜ ਦਿੰਦੇ ਨਾ ਦੱਸਣ ਹੱਥ ਵੀ ਨਹੀ ਕਰਦੇ ਅਸੀਂ ਇਧਰ ਮੁੜਨਾ ਪਿੱਛੋਂ ਆ ਕੇ ਭਾਵੇਂ ਵੱਜੇ ਕੁਛ ਉਹ ਐਕਸੀਡੈਂਟ ਰੋਜ਼ ਹੀ ਆਪਾਂ ਟੀ ਵੀ ਖ਼ਬਰਾਂ ਲਾ ਲਈਏ ਰੋਜ਼ ਚਾਰ ਮਰ ਗਏ ਪੰਜ ਮਰ ਗਏ ਇੱਕ ਮਰ ਗਿਆ ਦੋ ਮਰ ਗਏ ਐਈਂ ਆ ਬਸ ਦੁਨੀਆਂ ਹੋਰ ਡਰਾਈਵਰੀ ਆਉਂਦੀ ਨੀ ਬਸ ਰੋਡ ਟਰੈਫਿਕ ਵਧਾਇਆ ਪਿਆ ਇਹਨਾਂ ਨੇ ਨਿੱਕੇ ਨਿੱਕੇ ਬੱਚੇ ਵੀਹਕਲ ਲੈ ਕੇ ਤੁਰੇ ਫਿਰਦੇ ਆ ਨਹੀਂ ਮੁਕਤਸਰ ਦਾ ਵੱਡੇ ਸ਼ਹਿਰਾਂ 'ਚ ਤਾਂ ਹਜੇ ਹੈਗਾ ਬਈ ਮੈਨੂੰ ਥੋੜ੍ਹੇ ਕੇਅਰਫੁਲੀ ਪਰ ਮੁਕਤਸਰ ਦਾ ਤਾਂ ਕੋਈ ਹਾਲ ਨਹੀਂ ਮੁਕਤਸਰ 'ਚ ਤਾਂ ਬਹੁਤ ਜ਼ਿਆਦਾ ਟਰੈਫਿਕ ਆ ਜਾਂ ਇਹ ਵੀ ਹੈ ਚਲਾਨ ਭਰ ਕੇ ਜਾ ਹੁੰਦਾ

ਅਤੇ ਮੁਕਤਸਰ ਸ਼ਹਿਰ ਇਤਿਹਾਸਕ ਸ਼ਹਿਰ ਆ ਪਰ ਇੱਥੇ ਕੋਈ ਰੁਲ ਰੋਡ ਰੂਲ ਨਹੀਂ ਆ ਉਹ ਕਰਦਾ ਮੰਨਦਾ ਨਹੀਂ ਆ ਸਭ ਧੱਕਾ ਸਟਾਰਟ ਹੀ ਚੱਲੀ ਜਾਂਦੇ ਆ ਠੀਕ ਆ ਵਧੀਆ ਕੋਈ ਨਹੀਂ ਮਾਰ ਲਿਓ ਗੇੜਾ ਹੁਣ ਤਾਂ ਮਾਘੀ ਮੇਲੇ ਕਰਕੇ ਟਰੈਫਿਕ ਬਹੁਤ ਆ ਅੱਛਾ ਅੱਛਾ ਠੀਕ ਆ ਜੀ ਮਿਲੋ